ਪੰਜਾਬ ਦੇ ਵਿੱਚ ਜਿਹੜੇ ਮੁੱਖ ਬੈਂਕਿੰਗ ਜਾਂ ਬੀਮਾ ਦੇ ਰੁਝਾਨ ਹਨ ਉਹ ਹੁਣ ਜ਼ਿਆਦਾਤਰ ਡਿਜੀਟੇਲਾਈਜੇਸ਼ਨ ਵੱਲ ਹੈ ਬਹੁਤ ਜ਼ਿਆਦਾ ਨਵੇਂ ਪ੍ਰਾਈਵੇਟ ਬੈਂਕ ਜਿਹੜੇ ਹੈ ਉਹ ਆ ਰਹੇ ਹਨ ਅਤੇ ਬੈਂਕ ਜਿਹੜੇ ਹੈ ਮਾਈਕਰੋਫਾਈਨਾਂਸ ਵਗੈਰਾ ਛੋਟੇ ਛੋਟੇ ਲੋਨ ਜਿਹੜੇ ਹੈ ਉਹ ਦਿੰਦੇ ਹਨ ਲੋਕਾਂ ਦੀ ਡਿਵੈਲਪਮੈਂਟ ਵਾਸਤੇ ਲੋਕ ਸੈਲਫ ਹੈਲਪ ਗਰੁੱਪ ਬਣਾ ਕੇ ਮਾਈਕਰੋਫਾਈਨਾਂਸ ਦੇ ਥਰੂ ਬੈਂਕਾਂ ਤੋਂ ਲੋਨ ਲੈਂਦੇ ਹਨ ਅਤੇ ਬੈਂਕ ਜਿਹੜੇ ਹੈ ਨਾਲ ਨਾਲ ਹਰ ਇੱਕ ਬੈਂਕ ਇੰਸ਼ੋਰੈਂਸ ਦੀਆਂ ਸੇਵਾਵਾਂ ਵੀ ਦਿੰਦਾ ਹੈ ਉਸ ਨਾਲ ਲੋਕੀਂ ਆਪਣਾ ਜੀਵਨ ਬੀਮਾ ਜਾਂ ਪ੍ਰੋਪਟੀ ਦਾ ਬੀਮਾ ਜਾਂ ਹੋਰ ਤਰ੍ਹਾਂ ਦਾ ਬੀਮਾ ਕਰਵਾ ਸਕਦੇ ਹਨ ਹੋਰ ਬਹੁਤ ਸਾਰੀਆਂ ਪ੍ਰਾਈਵੇਟ ਫਿਨਟੈਕ ਕੰਪਨੀਆਂ ਵੀ ਇਸ ਪੇਸ਼ੇ ਵਿੱਚ ਇਸ ਲਾਈਨ ਦੇ ਵਿੱਚ ਆਈਆਂ ਹਨ ਜਿਹੜੀਆਂ ਕਿ ਆਪਣੇ ਆਪਣੇ ਤਰੀਕੇ ਨਾਲ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਫਾਇਨਾਂਸ ਦੇ ਪ੍ਰੋਡਕਟ ਹੈ ਉਹ ਪੇਸ਼ ਕਰਦੀਆਂ ਹਨ ਉਸ ਦੇ ਵਿੱਚ ਲੋਕਾਂ ਦਾ ਇੰਸ਼ੋਰੈਂਸ ਹੈ ਮੋਟਰ ਵਾਹਨ ਗੱਡੀਆਂ ਉਨ੍ਹਾਂ ਦਾ ਇੰਸ਼ੋਰੈਂਸ ਹੈ ਪ੍ਰੋਪਰਟੀ ਦਾ ਇੰਸ਼ੋਰੈਂਸ ਹੈ ਬੈਂਕ ਹਰ ਹਰ ਤਰ੍ਹਾਂ ਦੇ ਲੋਨ ਦਿੰਦਾ ਹੈ ਕਾਰ ਲੋਨ ਹਾਊਸ ਲੋਨ ਜਾਂ ਹੋਰ ਤਰ੍ਹਾਂ ਦੇ ਲੋਨ ਹੈ ਛੋਟੇ ਲੋਨ ਮਾਈਕਰੋ ਲੋਨ ਵੀ ਦਿੱਤੇ ਜਾਂਦੇ ਹੈ ਇੰਡਸਟਰੀਆਂ ਨੂੰ ਵੀ ਜਿਹੜੀ ਇਹ ਫੰਡਿੰਗ ਜਾਂ ਲੋਨ ਦਿੱਤੇ ਜਾਂਦੇ ਹੈ ਅਤੇ ਸਭ ਤਰ੍ਹਾਂ ਦੀ ਜਿਹੜੀ ਫਸਿਲਟੀ ਹੈ ਉਹ ਕਾਫ਼ੀ ਜ਼ਿਆਦਾ ਹੁਣ ਵੱਧ ਚੁੱਕੀ ਹੈ ਅਤੇ ਉਹਦੇ 'ਚ ਕਾਫ਼ੀ ਜ਼ਿਆਦਾ ਪਿਛਲੇ ਕੁਛ ਸਾਲਾਂ 'ਚ ਜ਼ਿਆਦਾ ਵਿਕਾਸ ਹੋਇਆ ਜਿਹੜਾ ਕਿ ਇੱਕ ਕਹਿ ਲਓ ਕਿ ਅੱਛਾ ਸਾਈਨ ਹੈ ਡਿਵੈਲਮੈਂਟ ਦਾ ਧੰਨਵਾਦ